ਪਾਣੀ ਨੂੰ ਫਿਲਟਰ ਕਰਨ ਅਤੇ ਸ਼ੁੱਧ ਕਰਨ ਲਈ ਅਸੀਂ ਅਸੀਂ ਗੱਲ ਕਰੀਏ ਤਾਂ ਕਾਫ਼ੀ ਤਰੀਕੇ ਨੇ ਕਾਫ਼ੀ ਘਰੇਲੂ ਤਰੀਕੇ ਹਨ ਜਿਵੇਂ ਕਿ ਫਿਲਟਰ ਪੇਪਰ ਯੂਸ ਕਰਨਾ ਅਤੇ ਜਿਹਦੇ ਵਿੱਚ ਅਸੀਂ ਜਦ ਪਾਣੀ ਪਾਈਦਾ ਅਤੇ ਜਿਹੜਾ ਕਾਗਜ਼ ਹੁੰਦਾ ਜਿਹੜਾ ਫਿਲਟਰ ਪੇਪਰ ਹੁੰਦਾ ਉਹ ਜਿਹੜੀ ਪਾਣੀ ਦੇ ਵਿੱਚੋਂ ਜਿੰਨੀ ਵੀ ਗੰਦਗੀ ਹੁੰਦੀ ਹੈ ਉਹ ਸਾਰੀ ਕੱਢ ਦਿੰਦਾ ਹੈ ਉਸ ਤੋਂ ਬਾਅਦ ਅਸੀਂ ਦੂਜਾ ਤਰੀਕੇ ਦੀ ਜੇ ਅਸੀਂ ਗੱਲ ਕਰੀਏ ਤਾਂ ਅਸੀਂ ਪਾਣੀ ਨੂੰ ਉਬਾਲ ਵੀ ਸਕਦੇ ਹਾਂ ਉਬਾਲਣਾ ਸਭ ਤੋਂ ਬੇਸਟ ਸਭ ਤੋਂ ਵਧੀਆ ਤਰੀਕਾ ਹੈ ਪਾਣੀ ਨੂੰ ਸਾਫ਼ ਅਤੇ ਸ਼ੁੱਧ ਕਰਨ ਦਾ ਤੀਜਾ ਹੈ ਜਿਹੜਾ ਪਿੰਡਾਂ ਦੇ ਵਿੱਚ ਬਹੁਤ ਮਸ਼ਹੂਰ ਤਰੀਕਾ ਹੈ ਘੜਾ ਲੈ ਲੈਣਾ ਘੜੇ ਦੇ ਵਿੱਚ ਪੱਥਰ ਸੁੱਟ ਦੇਣੇ ਕੌਲਾ ਪਾ ਦੇਣਾ ਅਤੇ ਰੇਤਾ ਪਾ ਦੇਣਾ ਅਤੇ ਉਹਨੂੰ ਉਹਦੇ ਵਿੱਚ ਪਾਣੀ ਪਾ ਕੇ ਧਰ ਦੇਣਾ ਅਤੇ ਸਮੇਂ ਬਾਅਦ ਕੁਝ ਸਮੇਂ ਬਾਅਦ ਦੇਖਣਾ ਕਿ ਜਦ ਰੇਤਾ ਅਤੇ ਜਿਹੜੇ ਪੱਥਰ ਹੈ ਥੱਲੇ ਬਹਿ ਜਾਣਾ ਅਤੇ ਉਸਤੋਂ ਬਾਅਦ ਪਾਣੀ ਦਾ ਜਿਹੜਾ ਪਾਣੀ ਜਿੰਨੀ ਵੀ ਗੰਦਗੀ ਹੈ ਉਹ ਪੱਥਰਾਂ ਦੇ ਨਾਲ ਥੱਲੇ ਬਹਿ ਜਾਂਦੀ ਹੈ ਅਤੇ ਉਪਰਲਾ ਪਾਣੀ ਜਿਹੜਾ ਸਤਹਿ ਦਾ ਪਾਣੀ ਹੈ ਉਹ ਬਿਲਕੁਲ ਸਾਫ਼ ਹੋ ਜਾਂਦਾ ਉਸ ਤੋਂ ਬਾਅਦ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਆਰ ਓ ਮਸ਼ੀਨ ਹੈ ਜਿਹੜੀ ਉਹ ਬਹੁਤ ਹੀ ਹੈ ਨਾਂ ਲ਼ ਲਾਭੀ ਹੈ ਪਾਣੀ ਨੂੰ ਸਾਫ਼ ਕਰਨ ਦੇ ਲਈ ਅਤੇ ਜ਼ਿਆਦਾਤਰ ਘਰਾਂ ਦੇ ਵਿੱਚ ਉਹੀ ਵਰਤੀ ਜਾਂਦੀ ਹੈ